ਬਾਈਕਿੰਗ ਕੁਦਰਤ ਦਾ ਆਨੰਦ ਲੈਣ ਕਸਰਤ ਕਰਨ ਅਤੇ ਨਵੀਆਂ ਥਾਵਾਂ 'ਤੇ ਪੜਚੋਲ ਕਰਨ ਦਾ ਇੱਕ ਵਧੀਆ ਤਰੀਕਾ ਹੈ ਹਾਲਾਂਕਿ ਇੱਕ ਸੁਰੱਖਿਅਤ ਅਤੇ ਨਿਰਵਿਘਨ ਸਵਾਰੀ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਸਹੀ ਤਿਆਰੀ ਅਤੇ ਰੱਖ ਰਖਾਵ ਦੀ ਲੋੜ ਹੁੰਦੀ ਹੈ ਜ਼ਰੂਰੀ ਬਾਈਕਿੰਗ ਏਅਰ ਵਿੱਚ ਇੱਕ ਹੈਲਮਟ ਇੱਕ ਬਾਈਕ ਪੰਪ ਇੱਕ ਮਲਟੀ ਟੂਲ ਅਤੇ ਇੱਕ ਵਾਧੂ ਟਿਊਬ ਅਤੇ ਇੱਕ ਪੈਚਕਿਟ ਇੱਕ ਪਾਣੀ ਦੀ ਬੋਤਲ ਅਤੇ ਸਨੈਕਸ ਹਨ ਇੱਕ ਹੈਲਮਟ ਸਿਰ ਨੂੰ ਗੰਭੀਰ ਸੱਟਾਂ ਤੋਂ ਬਚਾਉਂਦਾ ਹੈ ਜਦੋਂ ਕੋਈ ਇੱਕ ਸਾਈਕਲ ਪੰਪ ਲੋੜ ਪੈਣ 'ਤੇ ਟਾਇਰਾਂ ਨੂੰ ਫੁਲਾਉਂਦਾ ਹੈ ਇੱਕ ਮਲਟੀ ਟੂਲ ਕਿੱਟ ਮਕੈਨੀਕਲ ਸਮੱਸਿਆਵਾਂ ਨੂੰ ਠੀਕ ਕਰਨ ਲਈ ਵੱਧ ਵੱਧ ਸਥਾਨਾਂ ਨੂੰ ਜੋੜਦਾ ਹੈ ਇੱਕ ਵਾਧੂ ਟਿਊਬ ਅਤੇ ਪੈਚਕਿਟ ਟਿਊਬ ਜਾਂ ਟਾਇਰ ਵਿੱਚ ਛੋਟੇ ਮੋਰੀਆਂ ਦੀ ਮੁਰੰਮਤ ਕਰਨ ਲਈ ਮਦਦ ਕਰਦਾ ਹੈ ਲੰਬੇ ਸਫਰ ਦੌਰਾਨ ਹਾਈਡਰੇਟਡ ਅਤੇ ਊਰਜਾਵਾਨ ਰਹਿਣ ਲਈ ਪਾਣੀ ਦੀ ਬੋਤਲ ਅਤੇ ਸਨੈਕਸ ਬਹੁਤ ਜ਼ਰੂਰੀ ਹਨ ਐਮਰਜੈਂਸੀ ਲਈ ਪੱਟੀਆਂ ਜਾਲੀਦਾਰ ਐਂਟੀ ਸੈਪਟਿਕ ਵਾਈਪਸ ਦਰਦ ਨਿਵਾਰਕ ਟਵੀਜਰਸ ਸਨਸਕਰੀਨ ਅਤੇ ਕੀੜੇ ਮਕੌੜੇ ਅਤੇ ਲਿਪ ਬਾਮ ਵਰਗੀਆਂ ਚੀਜ਼ਾਂ ਇੱਕ ਫਸਟ ਏਡ ਕਿਟ ਵੀ ਜ਼ਰੂਰੀ ਹੈ ਕਿਸੇ ਵੀ ਸਥਿਤੀ ਲਈ ਤਿਆਰ ਰਹੋ ਅਤੇ ਆਪਣੇ ਬਾਈਕਿੰਗ ਸਾਹਸ ਦਾ ਹਮੇਸ਼ਾਂ ਆਨੰਦ ਲਓ